ਹਾਂਜੀ ਸਤਿ ਸ਼੍ਰੀ ਅਕਾਲ ਸਰ ਰਾਮ ਲਾਲ ਬੋਲ ਰਿਹਾ ਜੀ ਜੀ ਸਰ ਸਰ ਅਸੀਂ ਦਿੱਲੀ ਤੋਂ ਅਜੇ ਪਟਿਆਲੇ ਨਵੇਂ ਨਵੇਂ ਵਸੇ ਹਾਂ ਅਤੇ ਸਾਨੂੰ ਕੁਛ ਉਰੇ ਦੇ ਮਾਰਕੀਟ ਹੋ ਗਈ ਜਿਵੇਂ ਕੱਪੜਾ ਮਾਰਕੀਟ ਹੋ ਗਈ ਉਹਦੇ ਬਾਰੇ ਜਾਣੂ ਕਰਵਾਓ ਅਤੇ ਆਪਣਾ ਦਵਾਈਆਂ ਵਾਲੀ ਮਾਰਕਿਟ ਹੋ ਗਈ ਸਰ ਦਵਾਈਆਂ ਦੀ ਮਾਰਕੀਟ ਹੋ ਗਈ ਸਰ ਇਹਨਾਂ ਬਾਰੇ ਜਾਣੂ ਕਰਵਾਓ ਕੱਪੜਾ ਮਾਰਕਿਟ ਦੇ ਬਾਰੇ ਜਾਣੂ ਕਰਵਾਓ ਸਰ

ਰਿਹਾਇਸ਼ ਸਰ ਮੈਂ ਤੇਈ ਨੰਬਰ ਫਾਟਕ ਕਾਕਾ ਕਲੋਨੀ ਕਰੀ ਹੈ ਸਰ

ਹਾਂਜੀ ਸਰ

ਹਾਂਜੀ ਸਰ ਜੀ ਜੀ ਸਰ ਜੀ ਹਾਂਜੀ ਸਰ ਜੀ ਸਰ

ਜੀ ਸਰ ਜੀ ਹਾਂਜੀ ਹਾਂਜੀ

ਹਾਂਜੀ ਸਰ ਜੀ ਜੀ ਸਰ ਹਾਂਜੀ ਸਰ

ਮਿਲ ਸਕਦੀ ਹੈ ਜੀ ਹਾਂਜੀ ਠੀਕ ਐ ਸਰ

ਜੀ ਜੀ ਜੀ ਹਾਂਜੀ ਹਾਂਜੀ ਠੀਕ ਹੈ ਸਰ ਚਲੋ ਸਰ ਬਹੁਤ ਬਹੁਤ ਸ਼ੁਕਰੀਆਂ ਤੁਹਾਡਾ ਸਰ ਠੀਕ ਜ਼ਰੂਰ ਸਰ ਜ਼ਰੂਰ ਬਹੁਤ ਬਹੁਤ ਸ਼ੁਕਰੀਆ ਸਰ ਸ਼ੁਕਰੀਆ ਓਕੇ